ਜਿਹੜੀ ਮੈਂ ਆਪ ਤੌਰ 'ਤੇ ਡਰਾਇੰਗ ਬਣਾਉਂਦੀ ਹਾਂ ਨਾ ਜਿੱਦਾਂ ਥੰਬ ਡਰੋਇੰਗ ਬਣਾਉਣ ਦੀ ਆਪਣੇ ਹੱਥਾਂ ਨਾਲ ਡਰੋਇੰਗ ਬਣਾਉਂਦੀ ਹਾਂ ਅਤੇ ਜ ਆਮ ਤੌਰ 'ਤੇ ਡਰੋਇੰਗ ਦੇ ਵਿੱਚ ਮੈਂ ਸਬਜ਼ੀਆਂ ਵੀ ਯੂਜ ਕਰਦੀ ਹਾਂ ਜਿੱਦਾਂ ਕਰੇਲਿਆਂ ਨੂੰ ਕੱਟ ਕੇ ਠੀਕ ਹੈ ਉਨ੍ਹਾਂ ਨੂੰ ਪੇਂਟਿੰਗ ਦੇ ਵਿੱਚ ਡਿੱਪ ਕਰਕੇ ਉਨ੍ਹਾਂ ਦੇ ਪੱਤੇ ਵਗੈਰਾ ਬਣਾ ਕੇ ਅਤੇ ਐਂ ਛੋਟੇ ਛੋਟੇ ਫਲਾਵਰ ਬਣਾਉਂਦੀ ਹਾਂ ਜਿੱਦਾਂ ਭਿੰਡੀਆਂ ਨੂੰ ਕੱਟ ਕੇ ਉਨ੍ਹਾਂ ਨੂੰ ਉਹਦੇ 'ਚ ਡਿੱਪ ਕਰਕੇ ਪੇਂਟਿੰਗ ਦੇ ਵਿੱਚ ਉਹ ਫਲਾਵਰ ਬਣਾ ਲੈਂਦੇ ਹਾਂ ਅਤੇ ਸਿਨਰੀਆਂ ਬਣਾਉਂਦੇ ਹਾਂ ਵਧੀਆ ਵਧੀਆ ਚੀਜ਼ਾਂ ਯੂਜ ਕਰਦੇ ਹਾਂ ਉਨ੍ਹਾਂ ਪੇਂਟਿੰਗ ਦੇ ਵਿੱਚ